ਮੈਂ ਆਪਣੀ ਜਿੰਦਗੀ ਦੇ ਵਿੱਚ ਗ੍ਰਹਿਣ ਦੇਖਿਆ ਔਰ ਇਸ ਗ੍ਰਹਿਣ ਦੇਖਣ ਤੋਂ ਬਾਅਦ ਸਾਨੂੰ ਸਾਇੰਸ ਨਾਲ ਰਿਲੇਟਡ ਨਵੀਂ ਜਾਣਕਾਰੀ ਮਿਲਦੀ ਹੈ